ਅੱਠ ਫਰਬਰੀ ਉੱਨੀ ਸੌ ਇਕਿਆਸੀ ਪੰਜ ਜੁਲਾਈ ਦੋ ਹਜ਼ਾਰ ਇੱਕੀ ਪੰਜ ਸਤੰਬਰ ਦੋ ਹਜ਼ਾਰ ਦੋ ਇੱਕੀ ਅਕਤੂਬਰ ਦੋ ਹਜ਼ਾਰ ਚਾਰ ਨੌਂ ਜੂਨ ਦੋ ਹਜ਼ਾਰ ਦਸ